ਹਾਂ ਸਾਡੇ ਖੇਤਰ ਵਿੱਚ ਗਾਇਕੀ ਨਾਲ ਸੰਬੰਧਿਤ ਪ੍ਰੋਗਰਾਮ ਹੁੰਦੇ ਹਨ ਸਾਡੇ ਸ਼ਹਿਰ ਵਿੱਚ ਦੁਸਹਿਰੇ ਦੇ ਪ੍ਰੋਗਰਾਮ 'ਤੇ ਬੁਲਾਏ ਗਾਇਕ ਗਏ ਸਨ ਅਤੇ ਸਾਡੇ ਖੇਤਰ ਦੇ ਲੋਕਾਂ ਵਿੱਚ ਗਾਇਕੀ ਨਾਲ ਸੰਬੰਧਿਤ ਬਹੁਤ ਦਿਲਚਸਪੀ ਰੱਖਦੇ ਹਨ ਅਤੇ ਸਾਡੇ ਖੇਤਰ ਵਿੱਚ ਗਾਇਕ ਅਫਸਾਨਾ ਖਾਨ ਅਤੇ ਬੱਬਲ ਰਾਏ ਆਏ ਸੀ ਅਤੇ ਅਸੀਂ ਇਸ ਮੌਕੇ ਬਹੁਤ ਹੀ ਮਨੋਰੰਜਨ ਕੀਤਾ ਅਤੇ ਇਸ ਤਰ੍ਹਾਂ ਮੈਨੂੰ ਗਾਇਕੀ ਵਿੱਚ ਦਿਲਚਸਪੀ ਬਹੁਤ ਹੈ ਅਤੇ ਮੈਨੂੰ ਗਾਉਣ ਦਾ ਵੀ ਬਹੁਤ ਸ਼ੌਂਕ ਹੈ ਅਤੇ ਮੈਂ ਗਾਇਕੀ ਵਿੱਚ ਆਉਣਾ ਬਹੁਤ ਪਸੰਦ ਕਰਦੀ ਹਾਂ ਅਤੇ ਮੈਂ ਗਾਇਕੀ ਬਾਰੇ ਸਭ ਕੁਝ ਜਾਨਣਾ ਚਾਹੁੰਦੀ ਹਾਂ ਅਤੇ ਗਾਇਕੀ ਬਾਰੇ ਜਾਣ ਕੇ ਇਸ ਵਿੱਚ ਮੈਂ ਆਪਣੇ ਇਸ ਪੇਸ਼ਕਰ ਹਰ ਕਿੱਤੇ ਨੂੰ ਇਸ ਨੂੰ ਆਪਣੀ ਕਲਾ ਦਿਖਾਉਣ ਲਈ ਬਹੁਤ ਹੀ ਮਾਹਿਰ ਰਹਿੰਦੀ ਹਾਂ ਅਤੇ ਇਸ ਤਰ੍ਹਾਂ ਗਾਇਕੀ ਨੇ ਮੈਨੂੰ ਬਹੁਤ ਹੀ ਕਲਾ ਪ੍ਰਦਾਨ ਕੀਤੀ ਹੈ ਅਤੇ ਗਾਇਕੀ ਵਿੱਚ ਸਾਡੇ ਪੰ